ਪੰਜਾਬ ਵਿੱਚ ਜੋ ਵੀ ਖੇਤੀਬਾੜੀ ਸੈਕਟਰ ਹੈ ਉਸਨੂੰ ਕਿਸਾਨ ਇਕੱਲੇ ਦੇ ਵਸ ਦੀ ਵਿੱਚ ਦੀ ਇਹ ਗੱਲ ਨਹੀਂ ਹੈ ਕਿ ਉਹ ਇਕੱਲਾ ਹੀ ਆਪਣਾ ਖੇਤੀਬਾੜੀ ਦਾ ਸਾਰਾ ਕੰਮ ਕਰ ਸਕੇ ਇਸ ਕਰਕੇ ਜੋ ਮਜ਼ਦੂਰ ਭਾਈਚਾਰਾ ਸਮਾਜ ਸਾਡਾ ਹੈ ਉਹ ਰਲ ਮਿਲਕੇ ਸਾਡੇ ਕਿਸਾਨ ਦੇ ਨਾਲ ਮਿਹਨਤ ਕਰਵਾ ਕੇ ਆਪਣਾ ਵੀ ਸਮਾਂ ਵਧੀਆ ਪਾਸ ਕਰ ਰਿਹਾ ਹੈ ਅਤੇ ਖੇਤੀਬਾੜੀ ਸੈਕਟਰ ਵੀ ਭਾਈਚਾਰੇ ਨਾਲ ਰਲ ਕੇ ਕਾਫ਼ੀ ਮੱਦਦ ਕਰਕੇ ਖੇਤੀਬਾੜੀ ਦੇ ਸੈਕਟਰ ਨੂੰ ਉੱਪਰ ਲਿਜਾਇਆ ਜਾ ਰਿਹਾ ਹੈ